ਪੰਜਾਬ ਵਿੱਚ ਸੁਧਾਰ ਜਾਂ ਵਿਕਾਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇੱਥੋਂ ਦੇ ਕਈ ਲੋਕ ਤਾਂ ਇਹੋ ਜਿਹੇ ਹਨ ਜਿਹਨਾਂ ਨੂੰ ਕੁਛ ਪ੍ਰਸ਼ਾਸਨ ਬਾਰੇ ਪਤਾ ਹੀ ਨਹੀਂ ਇਸ ਲਈ ਉਹਨਾਂ ਨੂੰ ਵੀ ਪਨੁ ਸੁਧਾਰ ਦਾ ਵਿਕਾਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਦੋਂ ਸਾਡੇ ਵ ਹੈ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ ਕਈ ਲੋਕ ਹੈ ਜਿਹਨਾਂ ਨੂੰ ਪ੍ਰਸ਼ਾਸਨੀ ਵਿੱਤੀ ਜਾਂ ਕੋਈ ਕਾਨੂੰਨ ਦਾ ਨਿਆ ਦੇ ਬਾਰੇ ਵਿੱਚ ਪਤਾ ਨਹੀਂ ਹੁੰਦਾ ਇਸ ਲਈ ਇਹਨਾਂ ਨੂੰ ਸ ਇੱਕ ਸੁਖਮਨੀ ਸੋਸਾਇਟੀ ਜ਼ਿਲ੍ਹਾ ਸੁਖਮਨੀ ਸੁਸਾਇਟੀ ਬਣਾਈ ਗਈ ਹੈ ਜਿਹਨਾਂ ਲੋਕਾਂ ਨੂੰ ਇਹ ਇਸ ਬਾਰੇ ਨਹੀਂ ਪਤਾ ਹੁੰਦਾ ਉਹ ਇਹਨਾਂ ਸੋਸਾਇਟੀਆਂ ਵਿੱਚ ਜਾ ਕੇ ਪਤਾ ਕਰ ਸਕਦੇ ਹਨ ਪਰ ਪੰਜ ਕੁਝ ਜ਼ਿਆਦਾ ਲੋਕ ਤਾਂ ਇਹੀ ਹਨ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪਤਾ ਹੀ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਨਿਆ ਨਿਆ ਮਿਲੇਗਾ ਪਰ ਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕ ਸਾਰਿਆਂ ਵਿੱਚ ਇਹ ਕਰਨ ਅਤੇ ਸਾਰਿਆਂ ਨੂੰ ਵਿ ਵਿਕਾਸ ਦੇ ਲਈ ਸਰਕਾਰ ਸੁਧਾਰ ਲਈ ਦੱਸੇ ਅਤੇ ਅਤੇ ਸਾਨੂੰ ਵੀ ਕਿਸ ਹਰ ਤਰ੍ਹਾਂ ਦੇ ਨਿਆ ਦਾ ਨਿਆਇਕ ਵਿੱਤੀ ਵਿਧਾਨ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਜਾ ਕੇ ਨਿਆ ਮਿਲੇਗਾ ਅਤੇ ਔਰ ਆਰ ਟੀ ਆਈ ਦਾ ਵੀ ਇੱਕ ਹੈ ਰੈਜੀਡੈਸਲ ਡਿਸਟਰਿਕਟ ਸੁਖਮਨੀ ਸੋਸਾਇਟੀ ਹੈ ਜਿਸ ਤੋਂ ਜੋ ਨਿਆ ਦੇਣ ਦੇ ਵਿੱਚ ਹੁੰਦੀ ਹੈ ਜੇ ਕਿਸੇ ਨੂੰ ਨਹੀਂ ਪਤਾ ਉਸ ਕਿਸੇ ਦਾ ਕਿ ਅਧਿਕਾਰਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਇਹ ਅਲੱਗ ਅਲੱਗ ਸੁਸਾਇਟੀਆਂ ਬਣਾ ਕੇ ਉਹਨਾਂ ਨੂੰ ਦ ਦੱਸਣਾ ਚਾਹੀਦਾ ਹੈ ਘਰ ਘਰ ਜਾ ਕੇ ਉਹਨਾਂ ਨੂੰ ਦੱਸੋ ਧੰਨਵਾਦ